ਹਾਂਜੀ ਸ਼੍ਰੀਮਾਨ ਜੀ ਮੈਂ ਤੁਹਾਡੇ ਤੋਂ ਇੱਕ ਖਾਣੇ ਦਾ ਔਡਰ ਦਿੱਤਾ ਸੀ ਅਤੇ ਉਹ ਖਾਣਾ ਜਿਹੜਾ ਹੈਗਾ ਹੈ ਉਹ ਸੀਗਾ ਛੋਲੇ ਭਟੂਰੇ ਦਾ ਔਰ ਛੋਲੇ ਭਟੂਰੇ ਤੁਹਾਡਾ ਇੱਕ ਉਹ ਡਿਲੀਵਰੀ ਬੁਆਏ ਮੇਰੇ ਕੋਲ ਲੈ ਕੇ ਆਇਆ ਅਤੇ ਮੈਂ ਉਹ ਖਾਣਾ ਉਸ ਤੋਂ ਲੈ ਲਿਆ ਉਸ ਤੋਂ ਬਾਅਦ ਮੈਂ ਉਸ ਨੂੰ ਦੇਖਿਆ ਕਿ ਉਹ ਜਿਹੜਾ ਹੈ ਖੋਲ ਕੇ ਜਦ ਮੈਂ ਖਾਣਾ ਦੇਖਿਆ ਅਤੇ ਉਹ ਛੋਲੇ ਭਟੂਰੇ ਦੇ ਵਿੱਚ ਭਟੂਰਿਆਂ ਦੇ ਵਿੱਚ ਬਹੁਤ ਜ਼ਿਆਦਾ ਓਇਲੀ ਸੀਗੇ ਅਤੇ ਕੁਛ ਠੰਡੇ ਵੀ ਲੱਗ ਰਹੇ ਸੀ ਮੈਨੂੰ ਅਤੇ ਓਦੇ ਉਸ ਤੋਂ ਬਾਅਦ ਮੈਂ ਜਦੋਂ ਉਹ ਛੋਲਿਆਂ ਨੂੰ ਦੇਖਿਆ ਤਾਂ ਛੋਲੇ ਜਿੱਦਾਂ ਓਵਰ ਕੁਕ ਹੋ ਜਾਂਦਾ ਹੈ ਮਸਾਲਾ ਜਿੱਦਾਂ ਆਪਣਾ ਜ਼ਰੂਰਤ ਤੋਂ ਜ਼ਿਆਦਾ ਪੱਕ ਜਾਂਦੇ ਹਨ ਮਸਾਲੇ ਉਸ ਤਰ੍ਹਾਂ ਦੇ ਉਹ ਹੋ ਰਹੇ ਸਨ ਅਤੇ ਮੈਨੂੰ ਉਹ ਜਿਹੜੇ ਖਾਣਾ ਸੀਗਾ ਉਹ ਮੈਨੂੰ ਪਸੰਦ ਨਹੀਂ ਆ ਰਿਹਾ ਸੀਗਾ ਦੇਖਣ 'ਚ ਹੀ ਮੈਨੂੰ ਬਹੁਤ ਹੀ ਉਹ ਲੱਗ ਰਿਹਾ ਸੀਗਾ ਕਿ ਜਿੱਦਾਂ ਇਹ ਤਾਜ਼ਾ ਨਹੀਂ ਹੁੰਦਾ ਇਹ ਮੈਨੂੰ ਦੁਬਾਰਾ ਮਸਾਲੇਦਾਰ ਮਤਲਬ ਦੁਬਾਰਾ ਗਰਮ ਕਰਕੇ ਮੈਨੂੰ ਸਰਵ ਕੀਤਾ ਜਾ ਰਿਹਾ ਹੈ ਅਤੇ ਉਹ ਮੈਨੂੰ ਇੱਕ ਤਾਂ ਠੰਡਾ ਵੀ ਹੋ ਗਿਆ ਸੀ ਦੁਬਾਰਾ ਆਉਂਦੇ ਆਉਂਦੇ ਰਸਤੇ ਵਿੱਚ ਠੰਡਾ ਵੀ ਹੋ ਗਿਆ ਸੀਗਾ ਜੋ ਮੈਨੂੰ ਪਸੰਦ ਨਹੀਂ ਆ ਆ ਰਿਹਾ ਤਾਂ ਜੋ ਇਸ ਲੀਏ ਉਹ ਮੈਂ ਤੁਹਾਡੇ ਜਿਹੜਾ ਡਿਲੀਵਰੀ ਬੋਆਏ ਆ ਉਸ ਨੂੰ ਮੈਂ ਇਹ ਔਡਰ ਵਾਪਸ ਕਰ ਰਿਹਾ ਹਾਂ ਅਤੇ ਇਸ ਨੂੰ ਜਾਂ ਤਾਂ ਤੁਸੀਂ ਮੈਨੂੰ ਸਹੀ ਤਾਜ਼ਾ ਅਤੇ ਸਹੀ ਮ ਓ ਬਣਾਇਆ ਹੋਇਆ ਖਾਣਾ ਦੁਬਾਰਾ ਭੇਜੋ ਅੰਨਥਾ ਮੈਂ ਇਸਨੂੰ ਮੈਂ ਸਵੀਕਾਰ ਨਹੀਂ ਕਰਾਂਗਾ ਇਹ ਮੈਂ ਤੁਹਾਡੇ ਬੋਏ ਦੇ ਹੱਥ ਅਰੇ ਡਿਲੀਵਰੀ ਬੋਏ ਦੇ ਹੱਥ ਤੁਹਾਨੂੰ ਇਹ ਵਾਪਸ ਭੇਜ ਰਿਹਾ ਹੈ ਸੋ ਇਸ ਕਰਕੇ ਇਹ ਮੇਰੀ ਜਿਹੜੀ ਹੈਗੀ ਆ ਪ੍ਰਾਰਥਨਾ ਹੈ ਉਹ ਸਵੀਕਾਰ ਕਰੋ ਅਤੇ ਦੁਬਾਰਾ ਭੇਜੋ